ਸਤਿ ਸ਼੍ਰੀ ਅਕਾਲ ਜੀ ਸਾਡੇ ਭਾਰਤੀ ਇਤਿਹਾਸ ਵਿੱਚ ਯੋਗਾਨੰਦ ਪਰਮਹੰਸ ਜੀ ਇੱਕ ਮਹਾਨ ਰਿਸ਼ੀ ਹੋਏ ਹੈ ਮਹਾਨ ਯੋਗੀ ਹੋਏ ਹੈ ਉਹਨਾਂ ਦੀ ਕਿਤਾਬ ਹੈ ਇੱਕ ਯੋਗੀ ਕਥਾਮਿੱਥ ਅਤੇ ਉਹਨਾਂ ਨੇ ਸਾਡੇ ਜੀਵਨ ਦੇ ਐਸੇ ਐਸੇ ਪਹਿਲੂਆਂ ਨੂੰ ਛੂਹਿਆ ਐਸੀਆਂ ਐਸੀਆਂ ਗੱਲਾਂ ਬਾਰੇ ਚਰਚਾ ਕੀਤੀ ਹੈ ਅਧਿਆਤਮ ਦੀਆਂ ਡੁੰਘਾਈਆਂ ਬਾਰੇ ਅਤੇ ਜੋ ਧਿਆਨ ਦੀਆਂ ਗਹਿਰਾਈਆਂ ਵਿੱਚ ਜਾ ਕਰ ਕੇ ਅਸੀਂ ਕੀ ਕੀ ਅਨੁਭਵ ਕਰਦੇ ਹਾਂ ਸਾਡੀ ਆਤਮਾ ਅਤੇ ਪਰਮਾਤਮਾ ਦੇ ਮਿਲਣ ਸੰਬੰਧੀ ਕੀ ਅੜਚਣਾਂ ਆ ਸਕਦੀਆਂ ਕੀ ਕੀ ਰੁਕਾਵਟਾਂ ਨੇ ਇਹਨਾਂ ਸਭ ਵਿਸ਼ਿਆਂ ਦੇ ਉੱਪਰ ਯੋਗਾਨੰਦ ਪਰਮਹੰਸ ਜੀ ਨੇ ਜੋ ਵਿਵੇਚਨਾ ਕੀਤੀ ਹੈ ਉਹ ਅਦਭੁਤ ਹੈ ਕਿਤਾਬ ਪੜ੍ਹਨ ਤੋਂ ਪਹਿਲਾਂ ਸਾਡੀ ਸੋਚ ਕੁਛ ਹੋਰ ਹੁੰਦੀ ਹੈ ਲੇਕਿਨ ਜਦੋਂ ਅਸੀਂ ਉਹ ਕਿਤਾਬ ਨੂੰ ਪੜ੍ਹਦੇ ਜਾਂਦੇ ਹਾਂ ਤਾਂ ਅਸੀਂ ਫੀਲ ਕਰਦੇ ਹਾਂ ਕਿ ਸਾਡੇ ਅੰਦਰ ਇੱਕ ਅਮੋਲ ਚੂਲ ਪਰਿਵਰਤਨ ਹੋਣ ਦੀਆਂ ਸੰਭਾਵਨਾ ਜਨਮ ਲੈ ਰਹੀਆਂ ਅਤੇ ਮੈ ਉਸ ਕਿਤਾਬ ਨੂੰ ਪੜ੍ਹਿਆ ਜਿਹਦੇ ਵਿੱਚ ਮੈਂ ਪਾਇਆ ਕਿ ਜਦੋਂ ਤੱਕ ਸਾਡੇ ਦਿਵਯ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਸਾਡੇ ਮੱਥੇ 'ਤੇ ਇੱਕ ਤੀਜਾ ਨੇਤਰ ਹੁੰਦਾ ਹੈ ਜਿਹਨੂੰ ਪੁਰਾਣਾਂ ਵਿੱਚ ਨੂਰੇਇਮਾ ਕਿਹਾ ਅਤੇ ਥਰਡ ਆਈ ਕਿਹਾ ਬਾਇਬਲ 'ਚ ਠੀਕ ਹੈ ਗੀਤਾ ਵਿੱਚ ਦਿਵਯ ਚਕਸ਼ੂ ਕਿਹਾ ਤੀਜਾ ਨੇਤਰ ਸ਼ਿਵ ਨੇਤਰ ਸਾਡੇ ਗ੍ਰੰਥਾਂ ਵਿੱਚ ਕਿਹਾ ਉਹ ਗ੍ਰੰਥ ਉਹ ਨੇਤਰ ਨੂੰ ਜਦੋਂ ਅਸੀਂ ਕਿਸੇ ਪੂਰਨ ਮਹਾਂਪੁਰਸ਼ ਦੇ ਦੁਆਰਾ ਪ੍ਰਾਪਤ ਕਰਦੇ ਫਿਰ ਸਾਡੇ ਅੰਦਰ ਹੀ ਅਸੀਂ ਇੱਕ ਲਾਈਟ ਪ੍ਰਕਾਸ਼ ਜੋਤੀ ਨੂੰ ਦੇਖਦੇ ਹਾਂ ਅਤੇ ਉਹ ਦੇਖਣ ਤੋਂ ਬਾਅਦ ਹੀ ਸਾਡੇ ਮਨੋਕਸ਼ ਦਾ ਮਾਰਗ ਖੁੱਲ੍ਹਦਾ ਮੈਂ ਐਸਾ ਯੋਗਾਨੰਦ ਪਰਮਹੰਸ ਜੀ ਦੀ ਜਿਹੜੀ ਕਥਾ ਨ੍ਰਿੱਤ ਕਿਤਾਬ ਵਿੱਚ ਬੜੀ ਡੂੰਘਾਈ ਨਾਲ ਪੜ੍ਹਿਆ ਅਤੇ ਮੈਂ ਫੀਲ ਕਰਦਾ ਕਿ ਇਹ ਸੰਦੇਸ਼ ਜਨ ਜਨ ਤੱਕ ਜਾਣਾ ਚਾਹੀਦਾ ਤਾਂ ਕਿ ਸਭ ਲੋਕ ਸੰਸਾਰ ਦੀਆਂ ਜਿਹੜੀ ਭੌਤਿਕ ਵਸਤੂਆਂ ਕੇਵਲ ਉਹਨਾਂ ਦੇ ਪਿੱਛੇ ਨਾ ਦੌੜਦੇ ਰਹਿਣ ਆਪਣੇ ਆਤਮਿਕ ਜੀਵਨ ਵੱਲ ਵੀ ਧਿਆਨ ਦੇਣ ਅਤੇ ਮੈਂ ਇਹ ਚਰਚਾ ਅਕਸਰ ਆਪਣੇ ਮਿੱਤਰਾਂ ਨਾਲ ਦੋਸਤਾਂ ਨਾਲ ਕਰਦਾ ਰਹਿੰਦਾ ਹਾਂ ਸਤਿ ਸ਼੍ਰੀ ਅਕਾਲ ਜੀ